ਹਰ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਖੁਸ਼ ਕਰਨ ਲਈ ਹਰ ਇੱਕ ਵਿਅਕਤੀ ਨੂੰ ਆਪਣਾ ਆਪਣਾ ਨਜ਼ਰੀਆ ਰੱਖਣਾ ਪੈਂਦਾ ਹੈ ਕਿਉਂਕਿ ਹਰ ਇੱਕ ਵਿਅਕਤੀ ਪਰਿਵਾਰ ਵਿੱਚ ਵਿਚਰਦਾ ਹੈ ਕਈ ਵਾਰ ਵਿਅਕਤੀ ਆਪਣੇ ਪਰਿਵਾਰ ਨੂੰ ਵੇਖ ਕੇ ਖੁਸ਼ ਹੁੰਦਾ ਹੈ ਜਾਂ ਵਿਅਕਤੀ ਨੂੰ ਜੋ ਚੀਜ਼ ਚੰਗੀ ਲੱਗਦੀ ਹੈ ਉਹ ਜਦੋਂ ਉਹ ਉਸਨੂੰ ਪ੍ਰਾਪਤ ਹੁੰਦੀ ਹੈ ਤਾਂ ਵੀ ਉਸਨੂੰ ਖੁਸ਼ੀ ਮਿਲਦੀ ਹੈ ਜਿਵੇਂ ਕਿ ਊਂ ਗੁਰਮੁਖ ਬੰਦੇ ਹੈ ਜਿਹੜੇ ਉਹ ਜਦੋਂ ਗੁਰੂ ਘਰ ਜਾਂਦੇ ਹਨ ਪਾਠ ਕਰਦੇ ਹਨ ਤਾਂ ਉਹਨਾਂ ਦੇ ਮਨ ਨੂੰ ਉਦੋਂ ਸੰਤੁਸ਼ਟੀ ਮਿਲਦੀ ਹੈ ਅਤੇ ਉਹ ਖੁਸ਼ ਰਹਿੰਦੇ ਹਨ ਕਈ ਵਿਅਕਤੀ ਹੈ ਜਿਹੜੇ ਉਹ ਆਪਣੀ ਆਪਣੇ ਜੋਬ ਤੋਂ ਆਪਣੇ ਨੌਕਰੀ ਤੋਂ ਖੁਸ਼ ਹੁੰਦੇ ਹਨ ਕਈਆਂ ਨੂੰ ਇਹ ਹੁੰਦਾ ਕਿ ਵਿਹਲੇ ਰਹਿ ਕੇ ਖੁਸ਼ ਹੁੰਦੇ ਹਨ ਕਈ ਵਿਅਕਤੀ ਐਂ ਜਿਹੜੇ ਉਹ ਸਾਰਾ ਦਿਨ ਕੰਮ ਕਰਕੇ ਖੁਸ਼ ਹੁੰਦੇ ਹਨ ਖੁਸ਼ ਹੋਣਾ ਮਨ ਨੂੰ ਪ੍ਰਸੰਨ ਕਰਨਾ ਹੁੰਦਾ ਹੈ ਜਿਸ ਕਾਰਨ ਜਿਸ ਚੀਜ਼ ਤੋਂ ਬੰਦਾ ਪ੍ਰਸੰਨ ਹੁੰਦਾ ਹੈ ਉਦੋਂ ਉਸ ਨੂੰ ਖੁਸ਼ ਖੁਸ਼ੀ ਹੈ ਜਿਹੜੀ ਉਹ ਮਹਿਸੂਸ ਹੁੰਦੀ ਹੈ ਹਰ ਇੱਕ ਵਿਅਕਤੀ ਦਾ ਆਪਣਾ ਆਪਣਾ ਨਜ਼ਰੀਆ ਹੈ ਅਤੇ ਵਿਅਕਤੀ ਉਦੋਂ ਹੀ ਖੁਸ਼ ਹੁੰਦਾ ਜਦੋਂ ਉਸਦੇ ਮਨ ਭਾਉਂਦੀ ਚੀਜ਼ ਉਸਨੂੰ ਮਿਲਦੀ ਹੈ ਜਾਂ ਜਿਸ ਚੀਜ਼ ਨੂੰ ਉਹ ਦੇਖਣਾ ਚਾਹੁੰਦਾ ਹੈ ਉਹ ਉਸਨੂੰ ਦਿਖਦੀ ਹੈ ਉਸ ਕਾਰਨ ਹੀ ਵਿਅਕਤੀ ਖੁਸ਼ ਰਹਿੰਦਾ ਹੈ ਜਿਵੇਂ ਕਿ ਅਸੀਂ ਜਦੋਂ ਗੁਰੂ ਘਰ ਜਾਂਦੇ ਹਾਂ ਤਾਂ ਜਦੋਂ ਗੁਰੂ ਘਰ ਜਾ ਕੇ ਸਾਡੀ ਰੂਹ ਪ੍ਰਸੰਨ ਹੁੰਦੀ ਆ ਉਦੋਂ ਅਸੀਂ ਅਪ ਖੁਸ਼ ਹੁੰਦੇ ਹਾਂ ਇਸ ਤਰ੍ਹਾਂ ਹਰ ਇੱਕ ਵਿਅਕਤੀ ਦਾ ਖੁਸ਼ ਰਹਿਣਾ ਵੱਖ ਵੱਖ ਨਜ਼ਰੀਆ ਹੈ